ਹੈਲੋ ਹਾਂਜੀ ਮੈਨੂੰ ਨਾ ਰਸੋਈ ਦੇ ਵਿੱਚ ਕੰਮ ਕਰਨਾ ਬਹੁਤ ਵਧੀਆ ਲੱਗਦਾ ਕਿਉਂਕਿ ਜਦੋਂ ਤੁਹਾਡੇ ਬਣਾਏ ਹੋਏ ਕਿਸੇ ਵੀ ਭੋਜਨ ਦੇ ਨਾਲ਼ ਕੋਈ ਖੁਸ਼ ਹੁੰਦਾ ਸੰਤੁਸ਼ਟ ਹੁੰਦਾ ਅਤੇ ਬਹੁਤ ਵਧੀਆ ਲੱਗਦਾ ਮੈਨੂੰ ਰਸੋਈ 'ਚ ਕੰਮ ਕਰਨਾ ਬਹੁਤ ਵਧੀਆ ਲੱਗਦਾ ਔਰ ਮੈਨੂੰ ਸਭ ਤੋਂ ਵਧੀਆ ਲੱਗਦਾ ਸਰਦੀ ਦੇ ਵਿੱਚ ਸਾਗ ਬਣਾਉਣਾ ਸਾਗ ਅਤੇ ਮੈਨੂੰ ਕਈ ਵਾਰੀ ਆਪਣੇ ਆਪ 'ਤੇ ਪਰਾਊਡ ਫੀਲ ਹੁੰਦਾ ਵੀ ਜੋ ਮੇਰੇ ਸਾਗ ਦਾ ਟੇਸਟ ਹੈ ਉਹ ਕੋਈ ਹੋਰ ਨਹੀਂ ਬਣਾ ਸਕਦਾ ਮੈਨੂੰ ਐਨੇ ਵਧੀਆ ਤਰੀਕੇ ਦੇ ਨਾਲ਼ ਆਉਂਦਾ ਇੱਕ ਵਾਰੀ ਦੀ ਮੈਂ ਤੁਹਾਨੂੰ ਗੱਲ ਦੱਸਦੀ ਹਾਂ ਪਿੰਡ ਤੋਂ ਸਾਗ ਆਇਆ ਅਤੇ ਮੇਰੀ ਭੈਣ ਨੇ ਭੇਜਿਆ ਸੀਗਾ ਅਤੇ ਮੈਂ ਉਹ ਸਾਗ ਤੜਕਿਆ ਅਤੇ ਆਪਣੇ ਹਸਬੈਂਡ ਨੂੰ ਲੰਚ ਦੇ ਲਈ ਨਾਲ਼ ਪਾ ਤਾ ਅਤੇ ਮੈਂ ਇੱਕ ਡੱਬਾ ਹੋਰ ਐਕਸਟ੍ਰਾ ਪਾ ਤਾ ਕਿਉਂਕਿ ਹਮੇਸ਼ਾ ਜਦੋਂ ਸਾਗ ਬਣਾਈਦਾ ਅਤੇ ਇਹਨਾਂ ਦੇ ਕੁਲੀਗਜ਼ ਦੇ ਲਈ ਮੈਂ ਜ਼ਰੂਰ ਭੇਜਦੀ ਹਾਂ ਅਤੇ ਉਹਨਾਂ ਨੇ ਸਾਗ ਖਾਣ ਤੋਂ ਬਾਅਦ ਕਿਹਾ ਵੀ ਇਹ ਜਿਹੜਾ ਸਾਗ ਹੈ ਵੀ ਇਹ ਤਾਂ ਮੈਡਮ ਦੇ ਹੱਥਾਂ ਦਾ ਨਹੀਂ ਬਣਿਆ ਹੋਇਆ ਇਹ ਕਹਿੰਦੇ ਵੀ ਤੁਹਾਨੂੰ ਕਿਵੇਂ ਪਤਾ ਲੱਗਿਆ ਕਹਿੰਦੇ ਨਹੀਂ ਵੀ ਉਹਨਾਂ ਦਾ ਜਿਹੜਾ ਸਾਗ ਹੈ ਵੀ ਉਹਨਾਂ ਦੀ ਰੀਸ ਤਾਂ ਇਹ ਸਾਗ ਕਰ ਹੀ ਨਹੀਂ ਸਕਦਾ ਅਤੇ ਮੈਨੂੰ ਉਹ ਸੁਣ ਕੇ ਆ ਕੇ ਮੈਨੂੰ ਉਹਨਾਂ ਨੇ ਉਵੇਂ ਹੀ ਵਰਡਿੰਗ ਦੱਸੀ ਅਤੇ ਮੈਨੂੰ ਆ ਕੇ ਐਨਾ ਜ਼ਿਆਦਾ ਵਧੀਆ ਲੱਗਿਆ ਵੀ ਇੱਕ ਹੋਰ ਬਣਾਉਣ ਦਾ ਜਿਹੜਾ ਆਨੰਦ ਹੈ ਵੀ ਉਹ ਆਉਣ ਲੱਗ ਜਾਂਦਾ ਅਤੇ ਮੈਨੂੰ ਬਣਾ ਕੇ ਰਸੋਈ 'ਚ ਕੰਮ ਕਰਕੇ ਮੈਨੂੰ ਬਹੁਤ ਵਧੀਆ ਲੱਗਦਾ ਕਿਉਂਕਿ ਜੇ ਤੁਸੀਂ ਕਿਸੇ ਦੇ ਮਨ ਨੂੰ ਸੰਤੁਸ਼ਟ ਕਰਦੇ ਹੋ ਨਾ ਅਤੇ ਉਸ ਤੋਂ ਵਧੀਆ ਆਨੰਦ ਕਿਤੇ ਹੋਰ ਹੈ ਹੀ ਨਹੀਂ